ਹੈਲੋ

ਤੁਸੀਂ ਜੀ ਅਮਨ ਏਜੰਸੀ ਤੋਂ ਬੋਲ ਰਹੇ ਹਾਂ

ਹਾਂਜੀ ਪਹਿਲਾਂ ਮੈਡਮ ਤੁਸੀਂ ਇਦਾਂ ਦੱਸੋ ਕਿ ਤੁਸੀਂ ਤੁਹਾਡੇ ਕੋਲ ਦਿਨ ਕਿੰਨੇ ਨੇ ਵੀਕ ਲਈ ਪਲਾਨ ਕਰਨਾ ਤੁਸੀਂ ਕਿ ਮੰਥ ਲਈ ਪਲਾਨ ਕਰਨਾ ਹੈ ਠੀਕ ਹੈ ਮੈਮ ਅੱਗੇ ਆਪਣੇ ਕਿੰਨੇ ਫੈਮਲੀ ਮੈਂਬਰ ਹੋ ਤੁਸੀਂ ਓਕੇ ਤੁਸੀਂ ਮੈਮ ਇੱਦਾਂ ਦੱਸੋ ਕਿ ਤੁਸੀਂ ਮਤਲਬ ਕਿੱਦਾਂ ਦਾ ਟ੍ਰਿਪ ਪਲਾਨ ਕਰਨਾ ਚਾਹੁੰਦੇ ਹੋ ਕਿਸੇ ਧਾਰਮਿਕ ਜਗ੍ਹਾ 'ਤੇ ਜਾਣਾ ਹੈ ਜਾਂ ਕਿਸੇ ਐਡਵੈਂਚਰ ਜਗ੍ਹਾ 'ਤੇ ਜਾਣਾ ਜਾਂ ਕਿਸੇ ਪਹਾੜੀ ਇਲਾਕੇ 'ਤੇ ਜਾਣਾ ਕਿੱਦਾਂ ਦਾ ਟ੍ਰਿਪ ਚਾਹੁੰਦੇ ਹੋ ਤੁਸੀਂ ਠੀਕ ਹੈ ਜੀ ਤਾਂ ਤੁਸੀਂ ਮਤਲਬ ਪੂਰੇ ਪੰਜਾਬ ਦੇ ਵਿੱਚ ਇਹ ਟ੍ਰਿਪ ਪਲਾਨ ਕਰ ਰਹੇ ਹੋ ਕਿ ਆਊਟ ਆਫ ਪੰਜਾਬ ਜਾਣਾ ਹੈ ਠੀਕ ਹੈ ਜੀ ਅਤੇ ਤੁਹਾਡਾ ਬਜਟ ਕਿੰਨਾ ਕੁ ਹੈ ਕਿੰਨੀ ਕੁ ਤੁਸੀਂ ਮਨੀ ਸਪੈਂਡ ਕਰਨਾ ਚਾਹੁੰਦੇ ਹੋ ਇਸ ਟ੍ਰਿਪ 'ਤੇ ਮਤਲਬ ਹਾਂਜੀ ਹਾਂਜੀ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਸਾਡੇ ਕੋਲ ਪੱਚੀ ਹਜ਼ਾਰ ਤੋਂ ਵੀ ਪੈਕੇਜ ਸ਼ੁਰੂ ਹੁੰਦਾ ਹੈ ਪੰਜਾਹ ਹਜ਼ਾਰ ਤੋਂ ਵੀ ਪੈਕੇਜ ਸ਼ੁਰੂ ਹੁੰਦਾ ਹੈ ਤਾਂ ਜੇ ਤੁਸੀਂ ਪੱਚੀ ਹਜ਼ਾਰ ਵਾਲਾ ਪੈਕੇਜ ਲੈ ਰਹੇ ਹੋ ਹੁਣ ਤਾਂ ਤੁਹਾਨੂੰ ਰਹਿਣਾ ਉੱਥੇ ਮਿਲੇਗਾ ਪਰ ਉਹਦੇ ਵਿੱਚ ਖਾਣੇ ਦੀ ਫੈਸਿਲਿਟੀ ਨਹੀਂ ਹੋਏਗੀ ਅਗਰ ਤੁਸੀਂ ਪੰਜਾਹ ਕੁ ਹਜ਼ਾਰ ਦਾ ਮਤਲਬ ਬਜਟ ਲੈ ਕੇ ਚੱਲਦੇ ਹੋ ਤਾਂ ਫਿਰ ਤੁਹਾਨੂੰ ਖਾਣ ਦੇ ਨਾਲ ਨਾਲ ਰਹਿਣ ਦੇ ਨਾਲ ਨਾਲ ਖਾਣੇ ਦਾ ਵੀ ਉੱਥੇ ਸਹੁਲਤ ਮਿਲੇਗੀ ਠੀਕ ਹੈ ਜੀ ਅਤੇ ਮੈਂ ਤੁਹਾਨੂੰ ਪ੍ਰੈਫਰ ਕਰਾਂਗੀ ਜੇ ਤੁਸੀਂ ਹਜ਼ੂਰ ਸਾਹਿਬ ਵੱਲ ਜਾਓ ਤਾਂ ਤੁਹਾਡਾ ਮਤਲਬ ਕਿ ਘੱਟ ਖਰਚੇ ਦੇ ਵਿੱਚ ਤੁਸੀਂ ਵਧੀਆ ਘੁੰਮ ਫਿਰ ਸਕਦੇ ਹੋ ਉੱਥੇ ਜੀ ਉੱਥੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਨੇ ਜਿੱਥੇ ਤੁਸੀਂ ਮਤਲਬ ਮੱਥਾ ਟੇਕ ਸਕਦੇ ਹੋ ਅਤੇ ਮਤਲਬ ਕਿ ਤੁਹਾਨੂੰ ਨਾਲ ਮਤਲਬ ਕਿ ਗੱਡੀ ਵੀ ਪ੍ਰੋਵਾਈਡ ਕੀਤੀ ਜਾਏਗੀ ਜੋ ਤੁਹਾਨੂੰ ਅਲੱਗ ਅਲੱਗ ਗੁਰਦੁਆਰਾ ਸਾਹਿਬ ਲੈ ਕੇ ਜਾਏਗੀ ਅਤੇ ਪੰਜਾਹ ਹਜ਼ਾਰ ਦੇ ਵਿੱਚ ਤੁਸੀਂ ਪੰਜ ਫੈਮਲੀ ਮੈਂਬਰ ਹਫ਼ਤੇ ਲਈ ਟ੍ਰਿਪ ਜਾ ਸਕਦੇ ਹੋ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਜੀ ਹਾਂਜੀ ਹਾਂਜੀ ਨਾਲ ਇੱਥੋਂ ਤੱਕ ਕਿ ਪੰਜਾਹ ਹਜ਼ਾਰ ਦੇ ਵਿੱਚ ਅਸੀਂ ਤੁਹਾਨੂੰ ਇੱਕ ਗਾਈਡ ਵੀ ਪ੍ਰੋਵਾਈਡ ਕਰਾਂਗੇ ਜੋ ਤੁਹਾਨੂੰ ਅਲੱਗ ਅਲੱਗ ਹਿਸਟਰੀ ਮਤਲਬ ਕਿ ਹਰ ਇੱਕ ਗੁਰਦੁਆਰੇ ਦੀ ਤੁਹਾਨੂੰ ਹਿਸਟਰੀ ਵੀ ਮਤਲਬ ਕਿ ਦੱਸੇਗਾ ਕਿ ਜਿਸ ਨਾਲ ਤੁਹਾਡਾ ਫ਼ਾਇਦਾ ਵੀ ਹੋਏਗਾ ਹੈ ਨਾ ਉੱਥੇ ਗੁਰਦੁਆਰਾ ਸਾਹਿਬ ਜਾਣਾ ਵੀ ਹੈ ਤਾਂ ਤੁਹਾਨੂੰ ਇਕੱਲੇ ਇਕੱਲੇ ਇਤਿਹਾਸ ਬਾਰੇ ਵੀ ਉਹ ਦੱਸਣਗੇ ਹਾਂਜੀ ਹਾਂਜੀ ਇਹ ਸਾਡੀ ਏਜੰਸੀ ਤੁਹਾਨੂੰ ਮਤਲਬ ਕਿ ਇਹ ਐਡਵੈ ਮਤਲਬ ਕਿ ਐਡਵਾਂਟੇਜ ਦਵੇਗਾ ਕਿ ਤੁਹਾਨੂੰ ਖਾਣ ਪੀਣ ਦੇ ਨਾਲ ਨਾਲ ਵੀ ਅਤੇ ਰਹਿਣ ਦੀ ਵੀ ਸਹੂਲਤ ਮਿਲੇਗੀ ਸਾਰਾ ਕੁਛ ਹੀ ਤੁਹਾਨੂੰ ਉੱਥੇ ਮਿਲੇਗਾ ਹਾਂਜੀ ਹਾਂਜੀ ਹਾਂਜੀ ਹਾ ਹਾਂਜੀ ਉਹ ਸਾਡੀ ਜ਼ਿੰਮੇਵਾਰੀ ਹੈ ਜੀ ਅਸੀਂ ਸ਼ੁਰੂ ਤੋੰ ਤੁਹਾਨੂੰ ਪ੍ਰੋਵਾਈਡ ਕਰਾਂਗੇ ਤੁਸੀਂ ਮੈਨੂੰ ਹਾਂ ਜੀ ਅੱਜ ਤੁਸੀਂ ਮੈਨੂੰ ਹਾਂਜੀ ਹਾਂਜੀ ਤੁਸੀਂ ਮੈਨੂੰ ਡੇਟ ਫਿਕਸ ਕਰਕੇ ਦੱਸ ਦਓ ਕਿ ਤੁਹਾਨੂੰ ਕਿਹੜੀਆਂ ਕਿਹੜੀਆਂ ਡੇਟਾਂ ਚਾਹੀਦੀਆਂ ਨੇ ਅਤੇ ਮੈਂ ਉਸ ਅਕੋਰਡਿੰਗ ਮੈਂ ਆਪਣਾ ਦੇਖ ਲੈਂਦੀ ਹਾਂ ਕਿ ਸਾਨੂੰ ਉਹ ਡੇਟਾਂ ਫਰੀ ਨੇ ਤੁਸੀਂ ਮੈਨੂੰ ਡੇਟ ਦੱਸ ਦਓ ਤੁਸੀਂ ਕਿਹੜੇ ਮਹੀਨੇ ਜਾਣਾ ਅਤੇ ਕਿਹੜੀ ਤਰੀਕ ਨੂੰ ਜਾਣਾ ਹੈ ਮਾਰਚ ਮਾਰਚ ਦੇ ਮਤਲਬ ਸਟਾਰਟਿੰਗ ਸਾਡੀਆਂ ਡੇਟਸ ਬੁੱਕ ਨੇ ਮੈ ਮੈਮ ਹਾਂਜੀ ਮੈਮ ਸਾਡੇ ਦਸ ਤਾਰੀਕ ਤੱਕ ਤਾਂ ਸਾਡੇ ਸਲੋਟ ਬੁੱਕ ਹੈ ਜੇ ਤੁਸੀਂ ਮਤਲਬ ਕਿ ਮਿਡ ਮਾਰਚ ਜਾਂ ਐਂਡ ਆਫ ਮਾਰਚ ਦੇਖੋ ਤਾਂ ਅਸੀਂ ਤੁਹਾਨੂੰ ਡੇਟਸ ਪ੍ਰੋਵਾਈਡ ਕਰ ਸਕਦੇ ਹਾਂ ਜੇ ਤੁਹਾਡੇ ਨਹੀਂ ਨਹੀਂ ਮੈਮ ਇੰਨੀ ਗਰਮੀ ਨਹੀਂ ਹੁੰਦੀ ਉੱਥੇ ਵੈਦਰ ਬਿਲਕੁਲ ਮਤਲਬ ਕਿ ਨੈਚੁਰਲ ਵੈਦਰ ਹੁੰਦਾ ਨਾ ਜ਼ਿਆਦਾ ਗਰਮੀ ਹੁੰਦੀ ਹੈ ਨਾ ਸਰਦੀ ਹੁੰਦੀ ਤੁਹਾਨੂੰ ਇੱਦਾਂ ਦੀ ਕੋਈ ਦਿੱਕਤ ਨਹੀਂ ਆਏਗੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕਿਉਂਕਿ ਦਸ ਤਰੀਕ ਤੱਕ ਸਾਡੇ ਸਾਰੇ ਸਲੋਟ ਬੁੱਕ ਨੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਮਿਡ ਮਾਰਚ ਔਰ ਐਂਡ ਆਫ ਦੀ ਮਾਰਚ ਤੁਸੀਂ ਮਤਲਬ ਕਿ ਸਾਡੇ ਤੋਂ ਬੁਕਿੰਗ ਲੈ ਸਕਦੇ ਹੋ ਐਨੀ ਟਾਈਮ ਓਕੇ ਮੈਮ ਕੋਈ ਕੋਈ ਦਿੱਕਤ ਨਹੀਂ ਆ ਜੀ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਹਾਂ ਕੋਈ ਗੱਲ ਨਹੀਂ ਮੈਮ ਕੋਈ ਗੱਲ ਨਹੀਂ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰ ਸਕਦੇ ਨਹੀਂ ਨਹੀਂ ਸੋਰੀ ਫੋਰ ਦਾ ਇੰਨਕਨਵੀਨੀਅਸ ਮੈਮ ਸੋਰੀ ਹਾਂਜੀ ਹਾਂਜੀ ਨਹੀਂ ਨਹੀਂ ਇੱਦਾਂ ਦੀ ਦਿੱਕਤ ਤੁਹਾਨੂੰ ਨਹੀਂ ਆਏਗੀ ਤੁਸੀਂ ਐਨੀ ਟਾਈਮ ਸਾਨੂੰ ਕਾਲ ਕਰ ਸਕਦੇ ਹੋ ਟਵੰਟੀ ਫੋਰ ਸਾਡੀ ਮਤਲਬ ਕਿ ਸਾਨੂੰ ਅਸੀਂ ਕੋਲ ਅਟੈਂਡ ਕਰਦੇ ਹਾਂ ਜੀ ਤੁਹਾਡੀਆਂ ਹਾਂਜੀ ਹਾਂਜੀ ਓਕੇ ਜੀ ਥੈਂਕ ਯੂ ਮੈਮ ਹਾਂਜੀ ਹਾਂਜੀ ਓਕੇ ਜੀ ਓਕੇ ਜੀ ਥੈਂਕ ਯੂ ਮੈਮ